ਮੇਰੀ ਡਰਾਇੰਗ ਵਿੱਚ ਸਭ ਤੋਂ ਜ਼ਿਆਦਾ ਗਲਤੀ ਇਹ ਹੁੰਦੀ ਹੈ ਕਿ ਆਪਾਂ ਆਹ ਸੋਚਦੇ ਹਾਂ ਵੀ ਆਪਾਂ ਉਸ ਨੂੰ ਵਧੀਆ ਬਣਾ ਸਕਦੇ ਹਾਂ ਪਰ ਇਹ ਸੰਭਵ ਨਹੀਂ ਹੁੰਦਾ ਕਿਉਂਕਿ ਕਿਸੇ ਦੀ ਕੋਈ ਨਾ ਕੋਈ ਗਲਤੀ ਵਿੱਚ ਰਹਿ ਹੀ ਜਾਂਦੀ ਹੈ ਅਤੇ ਆਪਾਂ ਨੂੰ ਦੇਖਣ ਲਈ ਉਹ ਚਾਹੇ ਵਧੀਆ ਨਾ ਲੱਗੇ ਪਰ ਦੂਸਰੇ ਦੀ ਨਜ਼ਰਾਂ ਵਿੱਚ ਉਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਇਸ ਲਈ ਆਪਾਂ ਨੂੰ ਆਪਣੀ ਆਪਣੀ ਕਲਾ ਨੂੰ ਏਦਾਂ ਨਹੀਂ ਕਹਿਣਾ ਚਾਹੀਦਾ ਵੀ ਸਾਡੇ ਤੋ ਕੁ ਨਹੀਂ ਹੋ ਰਹੀ ਅਤੇ ਉਸ ਉੱਤੇ ਮਿਹਨਤ ਕਰ ਕਰ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਸ ਵਿੱਚ ਨਿਪੁੰਨ ਹੋਣ ਲਈ ਸਾਨੂੰ ਬਹੁਤ ਮਿਹਨਤ ਦੀ ਲੋੜ ਹੈ ਸਾਨੂੰ ਜਦ ਤੱਕ ਮਿਹਨਤ ਕਰਨੀ ਚਾਹੀਦੀ ਹੈ ਜਦੋਂ ਤੱਕ ਅਸੀਂ ਆਪਣੀ ਕਲਾ ਵਿੱਚ ਨਿਪੁੰਨ ਨਹੀਂ ਹੋ ਜਾਂਦੇ ਅਤੇ ਇਸ ਵਿੱਚ ਕੋਈ ਚੰਗਾ ਪੱਧਰ ਹਾਸਲ ਨਹੀਂ ਕਰ ਲੈਂਦੇ ਕਿਉਂਕਿ ਇਹ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਅਸੀਂ ਵਾਰ ਵਾਰ ਕਰ ਕਰਨ ਨਾਲ ਹੀ ਇਸ ਵਿੱਚ ਨਿਪੁੰਨ ਹੋ ਸਕਦੇ ਹਨ